ਹਾਂਜੀ ਬਲਰਾਜ ਸਿੰਘ ਜੀ ਬੋਲ ਰਹੇ ਹੋ ਫੁਰਸਤ ਰੈਸਟੋਰੈਂਟ ਤੋਂ ਮੈਂ ਤੁਹਾਡੇ ਕੋਲ ਇੱਕ ਔਡਰ ਬੁੱਕ ਕੀਤਾ ਸੀ ਅੱਧਾ ਘੰਟਾ ਪਹਿਲਾਂ ਦੁਪਹਿਰ ਦਾ ਲੰਚ ਵਾਸਤੇ ਕੀਤਾ ਸੀਗਾ ਪਰ ਹਾਲੇ ਤੱਕ ਪਹੁੰਚਿਆ ਨਹੀਂ ਤੁਸੀਂ ਆਪਦੇ ਜਿਹੜਾ ਬਰੋਸ਼ਰ ਹੈ ਜਾਂ ਤੁਹਾਡੀ ਜਿਹੜੀ ਵੈਬਸਾਈਟ ਹੈ ਉਹਤੇ ਲਿਖਿਆ ਹੋਇਆ ਕਿ ਅਸੀਂ ਪੰਦਰ੍ਹਾਂ ਮਿੰਟਾਂ ਦੇ ਵਿੱਚ ਡਿਲੀਵਰੀ ਕਰਾਂਗੇ ਅਤੇ ਨਾ ਤੁਹਾਡਾ ਡਿਲੀਵਰੀ ਬੋਆਏ ਜਿਹਦਾ ਤੁਸੀਂ ਫੋਨ ਨੰਬਰ ਦਿੱਤਾ ਹੋਇਆ ਉਹ ਫੋਨ ਚੱਕ ਰਿਹਾ ਸਾਡੇ ਘਰ ਗੈਸਟ ਆਏ ਹੋਏ ਨੇ ਉਹ ਕਹਿੰਦੇ ਸੀਗੇ ਕਿ ਅਸੀਂ ਅੱਧੇ ਘੰਟੇ 'ਚ ਜਾਣਾ ਅਤੇ ਪੰਦਰਾਂ ਮਿੰਟ ਤੋਂ ਮੈਂ ਫੋਨ ਉਹਦਾ ਡਿਲੀਵਰੀ ਬੋਆਏ ਦਾ ਟਰਾਈ ਕਰ ਰਿਹਾ ਉਹ ਆ ਨਹੀਂ ਰਿਹਾ ਅਤੇ ਕਿਸੇ ਕਿਹੜੇ ਐਂਗਲ 'ਤੇ ਪ੍ਰੋਬਲਮ ਆ ਰਹੀ ਹੈ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਜੇ ਤੁਹਾਡੇ ਕੋਲ ਇਥੋਂ ਸਮਾਨ ਚੱਲ ਪਿਆ ਤਾਂ ਉਸ ਡਿਲੀਵਰੀ ਬੋਆਏ ਨਾਲ ਕੰਟੈਕਟ ਕਰਕੇ ਦੱਸੋ ਕਿ ਉਹ ਕਿੱਥੇ ਕੁ ਪਹੁੰਚ ਗਿਆ ਹੈ ਹਾਲਾਂਕਿ ਮੈਂ ਤੁਹਾਨੂੰ ਐਡਰੈਸ ਵੀ ਲਿਖਾ ਤਾ ਸੀਗਾ ਐਡਰੈਸ ਸਾਡਾ ਜਿਹੜਾ ਹੈਗਾ ਉਹ ਪੈਟਰੋਲ ਪੰਪ ਦੇ ਬੈਕ ਸਾਈਡ 'ਤੇ ਬਸੀ ਰੋਡ 'ਤੇ ਪੰਪ ਦੀ ਬੈਕ ਸਾਈਡ 'ਤੇ ਲੋਕ ਸੇਵਕ ਕਲੋਨੀ ਵਿੱਚ ਹੈ ਉਥ ਉੱਥੇ ਸਕਿਉਰਟੀ ਗੇ ਗੇਟ 'ਤੇ ਬੈਠਾ ਹੁੰਦਾ ਚੌਂਕੀਦਾਰ ਉਹਨੂੰ ਤੁਸੀਂ ਪੁੱਛ ਲਿਓ ਜੇ ਤੁਹਾਡਾ ਡਿਲੀਵਰੀ ਬੋਆਏ ਨਵਾਂ ਹੈਗਾ ਤਾਂ ਉਹਨੂੰ ਜਲਦੀ ਰਸਤਾ ਦੱਸ ਦੇਵੇਗਾ ਕਿਰਪਾ ਕਰਕੇ ਇਹ ਔਡਰ ਜਲਦੀ ਭੁਗਤਾ ਦਿਓ ਜਿਹਦੇ ਵਿੱਚ ਮੈਂ ਚਾਰ ਪੰਜ ਆਈਟਮਾਂ ਕਹੀਆਂ ਸੀਗੀਆਂ ਇੱਕ ਤਾਂ ਸ਼ਾਹੀ ਪਨੀਰ ਕਿਹਾ ਸੀ ਇੱਕ ਦਾਲ ਮੱਖਣੀ ਸੀਗੀ ਇੱਕ ਮਿਕਸਡ ਵੈੱਜ ਵਿੱਚ ਸੀਗਾ ਅਤੇ ਰਾਇਤਾ ਸੀ ਨਾਲ ਥੋੜ੍ਹੀ ਜਿਹੀਆਂ ਰੋਟੀਆਂ ਅਤੇ ਚਾਵਲ ਸੀਗੇ ਇਹ ਉਹ ਹਾਲੇ ਤੱਕ ਪਹੁੰਚ ਨਹੀਂ ਰਿਹਾ ਅਤੇ ਉੱਧਰੋਂ ਜਿਹੜੇ ਸਾਡੇ ਗੈਸਟ ਆਏ ਸੀ ਉਹ ਜਾਣ ਦੀ ਕਾਹਲੀ ਕਰ ਰਹੇ ਨੇ ਉਹਨਾਂ ਨੇ ਦਿੱਲੀ ਪਹੁੰਚਣਾ ਹੈ ਫੇਰ ਦਿੱਲੀ ਪਹੁੰਚਣ ਦੇ ਵਿੱਚ ਉਹਨਾਂ ਦਾ ਟਾਈਮ ਕਾਫੀ ਘੱਟ ਰਹਿ ਜਾਏਗਾ ਕਿਰਪਾ ਕਰਕੇ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਰਿਓ ਅਤੇ ਡਿਲੀਵਰੀ ਬੋਆਏ ਨਾਲ ਕੰਟੈਕਟ ਕਰਕੇ ਕਿ ਕਿੰਨਾ ਕੁ ਮਿੰਟਾਂ 'ਚ ਪਹੁੰਚ ਰਿਹਾ